ਹਾਂਜੀ ਕੀ ਜਮਾਟੋ ਤੋਂ ਬੋਲਦੇ ਹੋ ਜੀ ਤੁਸੀਂ ਮੇਰੇ ਘਰ ਖਾਣਾ ਪਹੁੰਚ ਗਿਆ ਟਾਈਮ ਸਿਰ ਜੋ ਕਿ ਮੈਂ ਮੰਗਵਾਇਆ ਸੀ ਦਾਲ ਮੱਖਣੀ ਸਾਗ ਰਾਇਤਾ ਜੋ ਕਿ ਬਹੁਤ ਸਵਾਦ ਸੀ ਪਰ ਕੀ ਉਹਨਾਂ ਦਾ ਨਾ ਰੇਟ ਬਹੁਤ ਜ਼ਿਆਦਾ ਲੱਗਿਆ ਮੈਨੂੰ ਥੋੜ੍ਹਾ ਜਿਹਾ ਤੁਸੀਂ ਉਹਦਾ ਸੈਟਿੰਗ ਕਰਕੇ ਮੈਨੂੰ ਦੱਸੋਗੇ ਵੀ ਹੋਰ ਹਿਸਾਬ ਨਾਲ ਫਿਰ ਅਗਾਂਹ ਹੋਰ ਸਹੇਲੀਆਂ ਨੂੰ ਵੀ ਦੱਸੂੰਗੀ ਕਿ ਉੱਥੇ ਖਾਣਾ ਸਵਾਦ ਮਿਲਦਾ ਅਤੇ ਅਗਾਂਹ ਤੋਂ ਜੋ ਮੇਰੇ ਘਰ ਪਾਲਟੀ ਹੋ ਜਾ ਕੋਈ ਕੰਮ ਹੋਊਗਾ ਜਨਮਦਿਨ ਹੈ ਵਗੈਰਾ ਵੀ ਕੋਈ ਵੀ ਹੈਗਾ ਤਾਂ ਮੈਂ ਤੁਹਾਡੇ ਤੋਂ ਹੀ ਖਾਣਾ ਮੰਗਵਾਇਆ ਕਰੂੰਗੀ ਪਰ ਮੈਨੂੰ ਤੁਸੀਂ ਨਾ ਹੋਰ ਰੇਟ ਦਾ ਦੱਸੋ ਕਿ ਮੈਂ ਅਗਾਂਹ ਹੋਰ ਸਹੇਲੀਆਂ ਨੂੰ ਦਾ ਹੋਰ ਕਿਸੇ ਵੀ ਦੱਸਾਂ ਮੈਂ ਕਿ ਉੱਥੇ ਖਾਣਾ ਸਵਾਦ ਮਿਲਦਾ ਹੈ ਅਤੇ ਬਹੁਤ ਵਧੀਆ ਮਿਲਦਾ ਹੈ ਅਤੇ ਮਾੜਾ ਜਿਹਾ ਥੋੜ੍ਹਾ ਜਿਹਾ ਤੁਸੀਂ ਇਹ ਕਰਕੇ ਨਾ ਆਪਣਾ ਰੇਟ ਦੁਬਾਰੇ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਲੱਗਿਆ ਇਹਦਾ ਜਿਹਦਾ ਤੁਸੀਂ ਥੋੜ੍ਹਾ ਜਿਹਾ ਮੈਨੂੰ ਤੁਸੀਂ ਦੱਸ ਦਿਓ ਖਾਣਾ ਤੁਹਾਡਾ ਬਹੁਤ ਵਧੀਆ ਸੀਗਾ ਬਹੁਤ ਹੀ ਟੇਸਟੀ ਸੀ ਸਾਰਿਆਂ ਨੇ ਵਧੀਆ ਕਹਿ ਬਹੁਤ ਵਧੀਆ ਪਸੰਦ ਕੀਤਾ ਹੈ ਅਤੇ ਅਗਾਂਹ ਅਸੀਂ ਹੋਰ ਵੀ ਹੋਰ ਜਦੋਂ ਵੀ ਜਰੂਰਤ ਪਊਗੀ ਅਸੀਂ ਤੁਹਾਡੇ ਤੋਂ ਮੰਗਵਾਵਾਂਗੇ ਅਤੇ ਹੋਰਾਂ ਨੂੰ ਵੀ ਦੱਸਾਂਗੇ ਵੀ ਖਾਣਾ ਬਹੁਤ ਵਧੀਆ ਹੈ ਤੁਸੀਂ ਉੱਥੋਂ ਮੰਗਵਾ ਲਓ ਅਤੇ ਬਾਕੀ ਹੋਰ ਪਲੀਸ ਸਾਨੂੰ ਰੇਟ ਬਾਰੇ ਦੱਸ ਥੋੜ੍ਹਾ ਜਿਹਾ ਜੇ ਕਾਰਨ ਵੀ ਅਸੀਂ ਹੋਰ ਤੁਹਾਡੇ ਤੋਂ ਮੰਗਵਾਉਂਦੇ ਹੀ ਰਹੀਏ ਸ਼ੁਕਰੀਆ